ਤੀਹ ਅਗਸਤ ਦੋ ਹਜ਼ਾਰ ਪੰਜ ਪੰਦਰਾਂ ਜਨਵਰੀ ਦੋ ਹਜ਼ਾਰ ਸਤਾਰਾਂ ਇੱਕ ਅਪ੍ਰੈਲ ਉੱਨੀ ਸੌ ਅੱਸੀ ਛੱਬੀ ਦਸੰਬਰ ਦੋ ਹਜ਼ਾਰ ਚੌਵੀ ਇਕੱਤੀ ਸਤੰਬਰ ਦੋ ਹਜ਼ਾਰ ਦੋ